ਸਤਿ ਸ਼੍ਰੀ ਅਕਾਲ ਜੀ ਕੱਲ੍ਹ ਨਾ ਬਹੁਤ ਤੇਜ਼ ਹਵਾਵਾਂ ਵਗੀਆਂ ਉਹਦੇ ਨਾਲ ਨਾ ਸਾਡਾ ਜਿਹੜੀਆਂ ਲੈਂਡਲਾਈਨ ਦੀਆਂ ਤਾਰਾਂ ਨੇ ਅਤੇ ਇੰਟਰਨੈਟ ਬਰੋਡ ਬੈਂਡ ਦੀਆਂ ਤਾਰਾਂ ਨੇ ਸਭ 'ਚ ਟੁੱਟ ਭੱਜ ਹੋ ਗਈ ਹੈ ਕੀ ਤੁਸੀਂ ਇੱਕ ਐਮਰਜੰਸੀ ਹੈਲਪਲਾਈਨ ਸਾਨੂੰ ਦੇ ਸਕਦੇ ਹੋ ਜਾਂ ਕੋਈ ਆਪਣਾ ਕਸਟਮਰ ਕੇਅਰ ਦਾ ਬੰਦਾ ਇੱਥੇ ਭੇਜ ਸਕਦੇ ਹੋ ਜਿਹਦੇ ਨਾਲ ਤੁਸੀਂ ਇਹ ਜਿੰਨਾ ਵੀ ਨੁਕਸਾਨ ਹੋਇਆ ਉਹਨੂੰ ਦੇਖ ਸਕੋ ਅਤੇ ਸਾਡੀ ਮਦਦ ਕਰ ਸਕੋ ਤਾਂ ਜੋ ਅਸੀਂ ਦੁਬਾਰਾ ਸੁਵਿਧਾਵਾਂ ਦਾ ਲਾਭ ਲੈ ਸਕੀਏ